ਟੈਕਨੋਲਜੀ ਨੇ ਮਨੁੱਖੀ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ ਸੰਚਾਰ ਟੈਕਨੋਲਜੀ ਨੇ ਸੰਚਾਰ ਨੂੰ ਬਹੁਤ ਤੇਜ਼ ਅਤੇ ਆਸਾਨ ਬਣਾ ਦਿੱਤਾ ਹੈ ਹੁਣ ਅਸੀਂ ਦੁਨੀਆ ਵਿੱਚ ਕਿਸੇ ਵੀ ਕੋਨੇ 'ਤੇ ਬੈਠੇ ਆਪਣੇ ਦੋਸਤ ਮਿੱਤਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਣਕਾਰੀ ਟੈਕਨੋਲਜੀ ਨੇ ਜਾਣਕਾਰੀ ਵਿੱਚ ਪਹੁੰਚ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਹੁਣ ਅਸੀਂ ਇੰਟਰਨੈਟ ਦੀ ਮਦਦ ਨਾਲ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਇਕੱਠੀ ਕਰ ਸਕਦੇ ਹਾਂ ਕੰਮ ਟੈਕਨੋਲਜੀ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ ਅਸੀਂ ਆਪਣੇ ਰੋਲਟੀ ਕੰਮ ਨੂੰ ਕਰ ਸਕਦੇ ਹਾਂ ਅਤੇ ਕਿਤੇ ਵੀ ਕਿਸੇ ਕਿਸਮ ਦਾ ਕੰਮ ਸਮੇਂ ਸਿਰ ਕਰ ਸਕਦੇ ਹਾਂ ਵਿਸ਼ਵਾਸ ਟੈਕਨੋਲਜੀ ਨੇ ਦੁਨੀਆ ਨੂੰ ਇੱਕ ਛੋਟੀ ਜਿਹੀ ਜਗ੍ਹਾ 'ਤੇ ਸਥਿਤ ਕਰ ਦਿੱਤਾ ਹੈ ਹੁਣ ਅਸੀਂ ਦੂਜੇ ਦੇਸ਼ਾਂ ਵਿੱਚ ਲੋਕਾਂ ਨਾਲ ਆਸਾਨੀ ਨਾਲ ਜੁੜ ਸਕਦੇ ਹਾਂ ਅਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ ਵਿਸ਼ੇਸ਼ਣ ਟੈਕਨੋਲਜੀ ਨੇ ਡਾਟਾ ਵਿਸ਼ੇਸ਼ਣ ਨੂੰ ਆਸਾਨ ਬਣਾ ਦਿੱਤਾ ਹੈ ਇਸ ਨਾਲ ਕਾਰੋਬਾਰ ਅਤੇ ਹੋਰ ਸੰਸਥਾ ਨੂੰ ਵਧੇਰੇ ਪ੍ਰਭਾਵਸ਼ਾਲੀ ਫੈਸਲੇ ਲੈਣ ਵਿੱਚ ਮਦਦ ਕੀਤੀ ਹੈ ਸਿੱਖਿਆ ਓਨਲਾਈਨ ਵਿੱਚ ਜਾਣਨ ਲਈ ਬਹੁਤ ਮਦਦ ਕੀਤੀ ਹੈ ਕਈ ਉਦਾਹਰਨਾਂ ਹਨ ਤੁਸੀਂ ਟੈਕਨੋਲਜੀ ਨੂੰ ਇਹ ਖਾਸ ਪਹਿਲੂ ਬਾਰੇ ਹੋਰ ਜਾਣਨਾ ਚਾਹੁੰਦੇ ਹੋ